ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅਮਰਜੀਤ ਸਿੰਘ ਖਰੜ ਤੋਂ ਬੋਲ ਰਿਹਾ ਹਾਂ ਮੈਂ ਇੱਕ ਤੁਹਾਡਾ ਫ਼ੋਨ ਔਨਲਾਈਨ ਮੰਗਵਾਇਆ ਸੀ ਜਦੋਂ ਮੈਂ ਇਹ ਫੋਨ ਮੇਰੇ ਘਰ ਪਹੁੰਚਿਆ ਮੈਂ ਡੱਬਾ ਖੋਲ੍ਹ ਕੇ ਚੈੱਕ ਕੀਤਾ ਤਾਂ ਫੋਨ ਵਿੱਚ ਚਾਰਜਰ ਹੈ ਨਹੀਂ ਸੀ ਅਤੇ ਫ਼ੋਨ ਦੇ ਉੱਪਰ ਸਕਰੀਨ ਦੇ ਉੱਪਰ ਝਰੀਟਾਂ ਲੱਗੀਆਂ ਹੋਈਆਂ ਸੀ ਅਤੇ ਜਦੋਂ ਮੈਂ ਫ਼ੋਨ ਨੂੰ ਔਨ ਕੀਤਾ ਤਾਂ ਫੋਨ ਔਨ ਨਹੀਂ ਹੋ ਰਿਹਾ ਸੀ ਇਹ ਫੋਨ ਤੁਸੀਂ ਮੈਨੂੰ ਲੱਗਦਾ ਵੀ ਬਹੁਤ ਪੁਰਾਣਾ ਦੇ ਦਿੱਤਾ ਜਾਂ ਸੈਕਿੰਡਹੈਂਡ ਫ਼ੋਨ ਦੇ 'ਤਾ ਇਸ ਲਈ ਜਿਹੜਾ ਇਹ ਮੇਰਾ ਫ਼ੋਨ ਹੈ ਚੇਂਜ ਕੀਤਾ ਜਾਵੇ